ਹਾਂਜੀ ਮੈਂ ਆਪਣੇ ਖਾਣਾ ਪਕਾਉਣ ਦੇ ਸ਼ੌਂਕ ਨੂੰ ਕੂਕਿੰਗ ਦੇ ਸ਼ੌਂਕ ਨੂੰ ਪੇਸ਼ੇ ਵਜੋਂ ਜਿਹੜਾ ਕਰਨ ਤੋਂ ਸੋਚਿਆ ਸੀਗਾ ਪਰ ਆਪਣੇ ਇੰਡੀਆ ਦੇ ਵਿੱਚ ਕੋਈ ਵੀ ਮਤਲਬ ਕਿ ਸ਼ੈਫ ਨੂੰ ਜਿਹੜਾ ਬਹੁਤਾ ਚੰਗਾ ਜਿਹੜਾ ਨਹੀਂ ਸਮਝਿਆ ਜਾਂਦਾ ਸ਼ੈਫ ਦੀ ਜੋਬ ਲਈ ਸਾਨੂੰ ਮੁੰਬਈ ਵਰਗੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਹੈ ਇਹਨੀ ਇੱਥੇ ਤਾਂ ਅਸੀਂ ਸਿਰਫ ਪੰਜਾਬ ਦੇ ਵਿੱਚ ਤਾਂ ਸਿਰਫ ਅਸੀਂ ਰੈਸਟੋਰੈਂਟ ਖੋਲ ਸਕਦੇ ਹਾਂ ਇੱਕ ਢਾਬਾ ਖੋਲ ਸਕਦੇ ਹਾਂ ਅਤੇ ਸਾਡੇ ਪੇ ਜਿਹੜੇ ਪਰਿਵਾਰ ਨੇ ਉਹ ਇਹਨਾਂ ਚੀਜ਼ਾਂ ਨੂੰ ਬਹੁਤਾ ਜਿਹੜਾ ਪਸੰਦ ਨਹੀਂ ਕਰਦੇ ਇਸ ਲਈ ਮੈਂ ਆਪਣੀ ਜਿਹੜੀ ਟੀਚਿੰਗ ਵੱਲ ਸਟੱਡੀ ਵੱਲ ਫਿਰ ਜਦ ਆਈ ਹਾਂ ਮੈਂ ਪੀ ਐੱਚ ਡੀ ਸ਼ੁਰੂ ਕੀਤੀ ਹੈ ਪੀ ਐੱਚ ਡੀ ਕੰਪਲੀਟ ਕੀਤੀ ਹੈ ਪਰ ਮੈਂ ਕਦੇ ਨਾ ਕਦੇ ਜਿਹੜੀਆਂ ਆਪਣੇ ਸ਼ੌਂਕ ਲਈ ਜਿਹੜਾ ਖਾਣਾ ਬਣਾਉਣਾ ਹੈ ਨਾ ਕੂਕਿੰਗ ਕਰਨੀ ਇਹਨੂੰ ਇਹਨਾਂ ਚੀਜ਼ਾਂ ਨੂੰ ਇਹਨਾਂ ਦੀਆਂ ਵੀਡੀਓ ਬਣਾ ਕੇ ਯੂਟਿਊਬ 'ਤੇ ਪਾਇਆ ਕਰੂੰਗੀ ਤਾਂ ਜੋ ਮੇਰਾ ਜਿਹੜਾ ਆਪਣਾ ਡਰੀਮ ਪੂਰਾ ਹੋ ਸਕੇ